ਜ਼ਿੰਦਗੀ ਵਿੱਚ ਕਲਾ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕਿਉਂਕਿ ਹਰ ਇੱਕ ਚੀਜ਼ ਵਿੱਚ ਕਲਾ ਅਤੇ ਰੰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਚਿੱਤਰਕਾਰੀ ਕਰਕੇ ਆਪਣਾ ਇੱਕ ਪੇਸ਼ਾ ਪੇਸ਼ੇ ਵਜੋਂ ਕਰਦੀ ਹਾਂ ਜਿਸਦੀ ਜਿਸ ਦੇ ਵਿੱਚ ਕਿ ਮੈਂ ਆਪਣੀ ਪੇਂਟਿੰਗਸ ਨੂੰ ਵੇਚਦੀ ਹਾਂ ਅਤੇ ਨਵੀਆਂ ਨਵੀਆਂ ਜਗ੍ਹਾ 'ਤੇ ਜਾ ਕੇ ਉਹਨਾਂ ਜਗ੍ਹਾਵਾਂ ਨੂੰ ਆਪਣੇ ਕੈਂਨਵਸ ਵਿੱਚ ਉਤਾਰਦੀ ਹਾਂ ਅਤੇ ਇਸ ਨਾਲ ਮੈਨੂੰ ਬਹੁਤ ਹੀ ਹੌਂਸਲਾ ਮਿਲਦਾ ਹੈ ਅਤੇ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ ਅਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਹੀ ਖ਼ੁਸ਼ ਹੁੰਦੀ ਹਾਂ ਕਿਉਂਕਿ ਇਹ ਕਿਉਂਕਿ ਇਸ ਕੰਮ ਨੂੰ ਮੈਂ ਆਪਣੀ ਮਰਜ਼ੀ ਨਾਲ ਕਰ ਸਕਦੀ ਹਾਂ ਅਤੇ ਆਪਣੇ ਤਰੀਕੇ ਦੀ ਜ਼ਿੰਦਗੀ ਜੀ ਸਕਦੀ ਹਾਂ ਅਤੇ ਇਸ ਨਾਲ ਮੈਨੂੰ ਬਹੁਤ ਹੀ ਸਨਮਾਨ ਵੀ ਪ੍ਰਾਪਤ ਹੋਇਆ ਹੈ